ਮੈਨੂੰ ਲੱਗਦਾ ਵੀ ਜੇਕਰ ਸੱਭਿਆਚਾਰ ਦੀ ਗੱਲ ਕੀਤੀ ਜਾਵੇ ਅਤੇ ਉਹਨਾਂ ਦੀਆਂ ਪਰੰਪਰਾਵਾਂ ਨੂੰ ਕਾਇਮ ਰੱਖਣ ਦੀ ਗੱਲ ਕੀਤੀ ਜਾਵੇ ਤਾਂ ਸੱਭਿਆਚਾਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਡਾ ਪਹਿਰਾਵਾ ਆ ਜਾਂਦਾ ਫਿਰ ਉਸ ਤੋਂ ਬਾਅਦ ਆ ਜਾਂਦੀ ਆ ਸਾਡੀ ਖਾਣ ਪੀਣਾ ਅਤੇ ਸਾਡੇ ਬਿਲੀਵਸ ਮੈਨੂੰ ਲੱਗਦਾ ਵੀ ਜਿਹੜੇ ਪੰਜਾਬ ਦੇ ਲੋਕ ਨੇ ਹਾਲੇ ਵੀ ਤੁਸੀਂ ਉਹਨਾਂ ਦੀਆਂ ਬਜ਼ੁਰਗਾਂ ਨੂੰ ਦੇਖ ਲਉ ਜਾਂ ਤੀਵੀਆਂ ਨੂੰ ਦੇਖ ਲਉ ਤਾਂ ਉਹ ਸਲਵਾਰ ਕਮੀਜ਼ ਜਿਹੜਾ ਉਹਨਾਂ ਦਾ ਪਹਿਰਾਵਾ ਹੈ ਉਹ ਪਾਉਂਦੀਆਂ ਨੇ ਅਤੇ ਈਵਨ ਜਿਹੜੇ ਪੰਜਾਬ ਵਿੱਚ ਲੋਕ ਰਹਿੰਦੇ ਨੇ ਉਹ ਚਾਹੇ ਨਾ ਵੀ ਪੰਜਾਬੀ ਕਲਚਰ ਦੇ ਹੋਣ ਨਾ ਬਿਲੋਂਗ ਕਰਦੇ ਹੋਣ ਉਹ ਵੀ ਸਲਵਾਰ ਸੂਟ ਪਾਉਣਾ ਕੰਫਰਟੇਬਲ ਸਮਝਦੇ ਨੇ ਠੀਕ ਹੈ ਉਸ ਤੋਂ ਇਲਾਵਾ ਸਾਡੀ ਸਪੋਰਟਸ ਕਹਿ ਲਉ ਪੰਜਾਬ ਦੇ ਸਪੋਰਟਸ ਸਾਡੀ ਕਬੱਡੀ ਸਾਡੇ ਸਪੋਰਟਸ ਖੇਡ ਕੇ ਜਿਹੜੇ ਬੱਚੇ ਨੇ ਨੌਜਵਾਨ ਨੇ ਸਾਡੇ ਪੰਜਾਬ ਦੇ ਸੱਭਿਆਚਾਰ ਨੂੰ ਕਾਇਮ ਰੱਖਦੇ ਨੇ ਉਸ ਤੋਂ ਇਲਾਵਾ ਸਾਡੇ ਜਿਹੜੇ ਲੋਕ ਨੇ ਉਹਨਾਂ ਵਿੱਚ ਵਿਸ਼ਵਾਸ ਬਹੁਤ ਤਕੜਾ ਹੈ ਉਹ ਸ਼ਬਦ ਕੀਰਤਨ ਪਾਠ ਪੂਜਾ ਇਹਨਾਂ ਚੀਜ਼ਾਂ ਵੱਲ ਬਹੁਤ ਜ਼ਿਆਦਾ ਵਿਸ਼ਵਾਸ ਰੱਖਦੇ ਨੇ ਇਹਨਾਂ ਚੀਜ਼ਾਂ ਵਿ ਵੱਲ ਬਹੁਤ ਜ਼ਿਆਦਾ ਤਤਪਰ ਰਹਿੰਦੇ ਨੇ ਅਤੇ ਸਾਡੀਆਂ ਜਿਹੜੀਆਂ ਸਿੱਖਿਆਵਾਂ ਨੇ ਸਾਨੂੰ ਰੋਜ਼ ਜਿਹੜੀਆਂ ਨੇ ਚੇਤੇ ਕਰਵਾਉਂਦੇ ਨੇ ਪਾਠ ਸ਼ਬਦ ਕੀਰਤਨ ਤਾਂ ਬਸ ਇਸ ਤਰੀਕੇ ਨਾਲ਼ ਮੈਨੂੰ ਲੱਗਦਾ ਵੀ ਅਸੀਂ ਜਿਹੜਾ ਆਪਣਾ ਸੱਭਿਆਚਾਰ ਆ ਉਹਨੂੰ ਕਾਇਮ ਰੱਖਦੇ ਹਾਂ